ਮੈਂ ਭਵਿੱਖ ਵਿੱਚ ਗਾਣਾ ਚਾਹੁੰਦਾ ਹਾਂ ਇਸ ਬਾਰੇ ਮੇਰਾ ਇਕ ਟੀਚਾ ਹੈ ਅਤੇ ਮੈਂ ਆਪਣਾ ਟੀਚਾ ਆਪਣੀ ਮਿਹਨਤ ਨਾਲ ਪੂਰਾ ਕਰਨਾ ਚਾਹੁੰਦਾ ਹਾਂ ਹਜੇ ਤੱਕ ਮੈਂ ਤਾਂ ਸਿੱਖ ਰਿਹਾ ਹਾਂ ਅਤੇ ਖੂਬ ਮਿਹਨਤ ਕਰ ਰਿਹਾ ਹਾਂ ਮੈਂ ਆਪਣੀ ਇੱਛਾ ਅਨੁਸਾਰ ਪੰਜਾਬ ਦਾ ਇੱਕ ਚੰਗਾ ਗਾਇਕ ਬਣਨਾ ਚਾਹੁੰਦਾ ਹਾਂ ਤਾਂ ਜੋ ਮੈਨੂੰ ਹਰ ਕੋਈ ਪਹਿਚਾਣ ਸਕੇ ਅਤੇ ਜਾਣ ਸਕੇ